ਅੱਜ ਦੇ ਸਮੇਂ ਦੇ ਵਿੱਚ ਸੰਸਾਰ 'ਤੇ ਹਰ ਖੇਤਰ ਦੇ ਵਿੱਚ ਪੰਜਾਬੀ ਬੋਲਦਾ ਵਿਅਕਤੀ ਸਾਨੂੰ ਮਿਲ ਜਾਂਦਾ ਹੈ ਇਸ ਲਈ ਜਿੱਥੇ ਜਿੱਥੇ ਵੀ ਪੰਜਾਬੀ ਗਏ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਆਪਣੀ ਭਾਸ਼ਾ ਨੂੰ ਨਾਲ ਲੈ ਕੇ ਗਏ ਨੇ ਅਤੇ ਉੱਥੇ ਜਾ ਕੇ ਵੀ ਉਹਨਾਂ ਨੇ ਸੰਸਾਰ ਪੱਧਰ 'ਤੇ ਪੰਜਾਬੀ ਭਾਸ਼ਾ ਦਾ ਜਿਹੜਾ ਹੈਗਾ ਪੰਜਾਬੀ ਭਾਸ਼ਾ ਨੂੰ ਪ੍ਰਫਲ ਪ੍ਰਫੁੱਲਿਤ ਕੀਤਾ ਹੈ ਅਤੇ ਇੱਥੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਭਾਸ਼ਾ ਵਿਭਾਗ ਵੱਲੋਂ ਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੰਜਾਬੀ ਭਾਸ਼ਾ ਦੇ ਵਿੱਚ ਕਿਤਾਬਾਂ ਉਚੇਚੇ ਤੌਰ 'ਤੇ ਲਿਖਵਾਈਆਂ ਜਾਂਦੀਆਂ ਨੇ ਅਤੇ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਕੁਛ ਸੰਸਾਰ ਪ੍ਰਸਿੱਧ ਜਿਹੜੀਆਂ ਪੁਸਤਕਾਂ ਨੇ ਉਹਨਾਂ ਦਾ ਪੰਜਾਬੀ ਦੇ ਵਿੱਚ ਅਨੁਵਾਦ ਕਰਵਾਇਆ ਜਾਂਦਾ ਹੈ ਇਸ ਤੋਂ ਇਲਾਵਾ ਪੰਨ ਪੰਜਾਬ ਦੇ ਵਿੱਚ ਉਚੇਰੀ ਸਿੱਖਿਆ ਦਾ ਮਾਧਿਅਮ ਵੀ ਪੰਜਾਬੀ ਦੇ ਵਿੱਚ ਉਪਲਬਧ ਹੈ ਇਸ ਤੋਂ ਇਲਾਵਾ ਸਿੱਖਿਆ ਦੇ ਖੇਤਰ ਤੋਂ ਇਲਾਵਾ ਪੰਜਾਬੀ ਗਾਇਕੀ ਦੇ ਵਿੱਚ ਵੀ ਪੰਜਾਬੀ ਭਾਸ਼ਾ ਦਾ ਬਹੁਤ ਵੱਡਾ ਰੋਲ ਹੈ ਇਸਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੂਜੀ ਭਾਸ਼ਾ ਵਾਲੇ ਲੋਕਾਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕੀਤਾ ਹੈ ਅਤੇ ਦੂਜੇ ਦੇਸ਼ਾਂ ਦੇ ਵਿੱਚ ਵੀ ਲੋਕ ਪੰਜਾਬੀ ਨੂੰ ਸ ਅੰਗਰੇਜ਼ ਲੋਕ ਵੀ ਪੰਜਾਬੀ ਸਿੱਖਣ ਨੂੰ ਜਿਹੜੀ ਪਹਿਲ ਦੇ ਰਹੇ ਨੇ ਇਸ ਤੋਂ ਇਲਾਵਾ ਸਾਡੇ ਕੋਲ ਗੁਰਬਾਣੀ ਦਾ ਬਹੁਤ ਵੱਡਾ ਖਜ਼ਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਪੰਜਾਬੀ ਦੇ ਵਿੱਚ ਉਪਲਬਧ ਹੈ